ਫ਼ਿਰੋਜ਼ਪੁਰ ਜ਼ਿਲ੍ਹੇ ਦਾ ਮੌਸਮ ਵੀ ਹੁਣ ਨਾ ਤਾਂ ਜ਼ਿਆਦੇ ਠੰਡ ਪੈ ਰਹੀ ਹੈ ਅਤੇ ਨਾ ਹੀ ਜ਼ਿਆਦਾ ਗਰਮੀ ਪੈ ਰਹੀ ਹੈ ਵੀ ਮੌਸਮ ਠੀਕ ਜਿਹਾ ਹੈ ਵੀ ਜ਼ਿਆਦੀ ਠੰਡ ਨਹੀਂ ਹੈਗੀ ਹੁਣ ਆਪਾਂ ਫੁੱਲ ਪੱਖੇ ਚਲਾ ਕੇ ਸੌਂ ਰਹੇ ਹਾਂ ਵੀ ਦੁਪਹਿਰ ਇਹ ਗਰਮੀ ਹੋ ਰਹੀ ਹੈ ਸਵੇਰੇ ਸ਼ਾਮ ਦਾ ਵੀ ਮੌਸਮ ਠੀਕ ਹੈ ਅੱਗੇ ਆਪਾਂ ਵੇਖਿਆ ਸੀਗਾ ਵੀ ਪਿਛਲੀ ਵਾਰ ਆਪਾਂ ਫ਼ਿਰੋਜ਼ਪੁਰ ਨੂੰ ਪਤਾ ਹੀ ਹੈ ਆਪਾਂ ਨੂੰ ਫ਼ਿਰੋਜ਼ਪੁਰ 'ਚ ਬਹੁਤ ਹੜ ਆਏ ਸੀਗੇ ਐਤਕੀਂ ਉਹ ਕੰਮ ਨਹੀਂ ਹੈਗਾ ਅਤੇ ਵੀ ਅੱਗੇ ਹਾੜ ਆ ਗਏ ਲੋਕਾਂ ਦੀਆਂ ਮੱਝਾਂ ਰੁੜ ਗਈਆਂ ਘਰ ਰੁੜ ਗਏ ਬਹੁਤ ਔਖਾ ਸੀਗਾ ਉਦੋਂ ਬਚਣਾ ਬੰਦਿਆਂ ਨੂੰ ਅਤੇ ਹੁਣ ਉਹ ਕੰਮ ਨਹੀਂ ਹੈਗਾ ਹੁਣ ਤਾਂ ਬਸ ਮੌਸਮ ਦੇ ਬਹੁਤ ਫ਼ਰਕ ਹੈ ਅਤੇ ਅੱਗੇ ਆਪਾਂ ਮੌਸਮ ਦੇ ਵੀ ਵੇਖਿਆ ਜਾਵੇ ਤਾਂ ਆਪਾਂ ਬਦਲਾਵ ਬਹੁਤ ਵੇਖੇ ਨੇ ਵੀ ਕਦੀ ਬਦਲਾਵ ਬਹੁਤ ਮੌਸਮ ਦਾ ਸੀਗਾ ਕਦੀ ਕੁਛ ਹੋ ਗਿਆ ਕਦੀ ਆਪਾਂ ਕਹਿਣੇ ਇੱਥੇ ਪਾਣੀ ਆ ਗਿਆ ਇੱਥੇ ਆ ਗਿਆ ਉਹ ਸਿਸਟਮ ਹੁਣ ਕੋਈ ਨਹੀਂ ਹੁਣ ਤਬਦੀਲੀ ਮੌਸਮ 'ਚ ਆ ਵੀ ਜਿਸ ਹਿਸਾਬ 'ਤੇ ਮੌਸਮ ਚੇਂਜ ਹੋਣਾ ਚਾਹੀਦਾ ਅੱਗੇ ਕੱਤੇ ਦੇ ਮਹੀਨੇ 'ਚ ਵੀ ਫੁੱਲ ਠੰਡ ਪੈਣ ਲੱਗ ਪੈਂਦੀ ਸੀ ਰਜਾਈਆਂ ਲੋਕਾਂ ਨੇ ਲੈ ਲੈਣੀਆਂ ਹੁਣ ਉਹ ਮੌਸਮ 'ਚ ਕੋਈ ਖ਼ਾਸ ਨਹੀਂ ਹੈਗਾ ਅਗੇ ਹੈ ਸੀ ਹੁਣ ਉਹ ਕੰਮ ਆਪਣੇ ਫ਼ਿਰੋਜ਼ਪੁਰ 'ਚ ਇੰਨਾਂ ਨਹੀਂ ਹੈ ਹੁਣ ਪਿਛਲੀ ਵਾਰ ਆਪਾਂ ਵੇਖਿਆ ਵੀ ਗਰਮ ਸਰਦੀ ਫੁਲ ਪਈ ਹੈ ਬਹੁਤ ਫ ਸਰਦੀ ਸੀਗੀ ਲੋਕਾਂ ਦਾ ਸਰਦੀ ਦੇ ਨਾਲ ਬੁਰਾ ਹਾਲ ਹੋ ਗਿਆ ਹੁਣ ਵੀ ਨਹੀਂ ਹੈ